ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਬਹੁਤ ਬਦਲਾਅ ਆ ਰਿਹਾ ਜੀ ਅੰਮ੍ਰਿਤਸਰ ਪਹਿਲਾਂ ਨਾ ਪਹਿਲੇ ਨਾ ਵਧੀਆ ਚੱਲ ਰਿਹਾ ਜੀ ਹੁਣ ਪਹਿਲਾਂ ਘਬਰਾਉਂਦਾ ਸੀਗਾ ਕਲਾਸ ਦੇ ਵਿੱਚ ਥੋੜ੍ਹਾ ਜਿਹਾ ਜਦੋਂ ਸੁਰ ਲਗਾਉਂਦਾ ਸੀ ਜਾਂ ਸਿੱਖਦਾ ਸੀ ਉਦੋਂ ਵੀ ਘਬਰਾਹਟ ਮਹਿਸੂਸ ਕਰਦਾ ਸੀ ਪਰ ਹੁਣ ਅੱਗੇ ਨਾ ਬਹੁਤ ਬੈਟਰ ਕਰ ਰਿਹਾ ਜੀ ਦੂਸਰੇ ਬੱਚਿਆਂ ਨਾਲ ਵੀ ਬੈਟਰ ਕਰ ਰਿਹਾ ਅੱਗੇ ਸੁਰਤਾਲ ਦੇ ਵਿੱਚ ਵੀ ਗੜਬੜੀ ਕਰਦਾ ਸੀ ਜਦੋਂ ਸੁਰ ਲਗਾਉਂਦਾ ਸੀ ਥੋੜ੍ਹਾ ਜਿਹਾ ਸੰਗਦਾ ਵੀ ਸੀਗਾ ਹੌਲੀ ਹੌਲੀ ਸੰਗ ਵੀ ਖੁੱਲ ਗਈ ਉਹਦੀ ਉਹ ਦੂਸਰੇ ਬੱਚਿਆਂ ਨੂੰ ਵੇਖਦਾ ਉਹ ਤੋਂ ਮੋਟੀਵੇਟ ਹੁੰਦਾ ਬਾਕੀ ਉਹ ਹਰਮੋਨੀਅਮ ਤਾਂ ਉਹਨੂੰ ਸਿਖਾ ਹੀ ਦਿੱਤਾ ਸੀ ਵਧੀਆ ਹੁਣ ਹੱਥ ਟਿਕਾਉਣ ਲੱਗ ਗਿਆ ਹਰਮੋਨੀਅਮ ਦੇ ਵਿੱਚ ਸਾਰੇ ਸੁਰ ਪ ਪਕੜ ਲੈਂਦਾ ਗਾ ਤਾਂ ਹੌਲੀ ਹੌਲੀ ਉਹਨੂੰ ਤਬਲੇ 'ਤੇ ਵੀ ਹੁਣ ਹੱਥ ਟਿਕਾਉਣੇ ਸ਼ੁਰੂ ਕਰਾ ਦਾਂਗੇ ਉਹ ਦੂ ਬਾਅਦ ਔਰਗਨ ਦੇ 'ਤੇ ਐਂ ਕਰਦਾ ਕਰਦਾ ਅੱਗੇ ਨੂੰ ਸਟੈਪ ਬਾਏ ਸਟੈਪ ਵਧਦਾ ਜਾਵੇਗਾ ਹਾਂਜੀ ਹਾਂਜੀ ਹਾਂਜੀ ਇੱਥੇ ਹੁਣ ਦੂਸਰੇ ਬੱਚਿਆਂ ਨੂੰ ਵੇਖਦਾ ਅਤੇ ਉੱਥੇ ਵਧੀਆ ਹੁੰਦਾ ਇਹਨੂੰ ਵੀ ਇਹ ਵੀ ਕਹਿੰਦਾ ਵੀ ਹਾਂਜੀ ਮੈਂ ਵੀ ਕਰਾਂ ਤੁਹਾਨੂੰ ਦੇਖਦਾ ਉਹਨਾਂ ਤੋਂ ਉਤਸ਼ਾਹਿਤ ਹੁੰਦਾ ਬਾਕੀ ਹਰਮੋਨੀਅਮ ਤਾਂ ਹੁਣ ਬਹੁਤ ਵਧੀਆ ਵਜਾਉਣ ਲੱਗ ਗਿਆ ਜੀ ਇਹ ਬਾਕੀ ਸੁਰ ਵੀ ਵਧੀਆ ਲਾ ਲੈਂਦਾ ਬਾਕੀ ਇਹਦਾ ਠੰਡੇ ਕਿਉਂਕਿ ਇਹਦੀ ਨਾ ਖੁਰਾਕ ਵੱਲ ਵੀ ਧਿਆਨ ਦਿਓ ਜੇ ਇੱਕਦਮ ਗਰਮ ਪਾਣੀ ਨਾ ਪੀਵੇ ਇੱਕਦਮ ਠੰਡਾ ਪਾਣੀ ਵੀ ਨਾ ਪਵੇ ਤੇ ਗੁਣਗਣਾ ਪਾਣੀ ਜ਼ਿਆਦਾਤਰ ਰਿਆਜ਼ ਰੱਖੇ ਨਾਲ ਜਦੋਂ ਵੀ ਇਹਨੂੰ ਤੁਸੀਂ ਆਉਣਾ ਹੋਵੇ ਕਿਤੇ ਵੀ ਜਾਣਾ ਹੋਵੇ ਨਾਲੇ ਦੋ ਗੁਣਗੁਣਾ ਪਾਣੀ ਜ਼ਰੂਰ ਨਾਲ ਪਾ ਲਿਆ ਕਰੋ ਵੀ ਬੋਤਲ ਦੇ ਵਿੱਚ ਹਾਂਜੀ ਉਹਦੇ ਨਾਲ ਗਲਾ ਵਧੀਆ ਰੈਟ ਰਹਿੰਦਾ ਹਾਂਜੀ ਕਿਉਂਕਿ ਇੱਕ ਮੌਸਮ ਬਦਲ ਰਿਹਾ ਨਾ ਤਾਂ ਕਰਕੇ ਵੀ ਉਹਨੂੰ ਠੰਡੇ ਕੋਈ ਤਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਰੱਖਿਉ ਜੀ ਵੀ ਗਲਾ ਛੇਤੀ ਖਰਾਬ ਹੋ ਜਾਂਦਾ ਬਾਕੀ ਹੌਲੀ ਹੌਲੀ ਅਤੇ ਬਸ ਅੱਗੇ ਕਰ ਹੀ ਰਿਹਾ ਤੁਹਾਡਾ ਬੱਚਾ ਬਾਕੀ ਵਧੀਆ ਸੁਰ ਤਾਲ ਵੀ ਵਧੀਆ ਕਰ ਲੈਂਦਾ ਬਾਕੀ ਸਟਡੀ 'ਚ ਵੀ ਬਹੁਤ ਵਧੀਆ ਕਰ ਰਿਹਾ ਜੋ ਸੁਰ ਲਿਖਾਈ ਦੇ ਆ ਵੀ ਆਹ ਕਿਸ ਤਰ੍ਹਾਂ ਲਿਖਣੇ ਆ ਪੌੜੀ ਦਰ ਪੌੜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਬਾਕੀ ਇਹਨੂੰ ਕਹਿ ਦਿਓ ਸਟਡੀ ਦੇ ਨਾ ਨਾਲ ਨਾਲ ਮਿਊਜਿਕ ਦਾ ਸਟਡੀ ਵੀ ਕਰਿਆ ਕਰੇ ਉਹ ਸਟਡੀ ਵੀ ਜ਼ਰੂਰੀ ਆ ਮਿਊਜਕ ਵੀ ਜ਼ਰੂਰੀ ਦੋਨਾਂ ਨੂੰ ਟਾਈਮ ਦਿਆ ਕਰੇ ਹਾਂਜੀ ਬਾਕੀ ਮਿਊਜਿਕ ਦੇ ਵਿੱਚ ਤੁਹਾਨੂੰ ਅੱਗੇ ਜਿਵੇਂ ਜਿਵੇਂ ਵੱਧਦਾ ਜਾਵੇਗਾ ਉਵੇਂ ਤੁਹਾਡੇ ਨਾਲ ਤੁਹਾਡੀ ਤਰੱਕੀ ਨਾਲੇ ਆਪਣੇ ਵਧੀਆ ਦੇਸ਼ ਦੀ ਵੀ ਤਰੱਕੀ ਆ ਕੋਈ ਇੰਨੇ ਨੂੰ ਤਕੜੇ ਹੁਣ ਬਾਹਰ ਜਾ ਜਾ ਕੇ ਆਪਣੀ ਹੁਣ ਗਾ ਰਹੇ ਆ ਦਲਜੀਤ ਦੁਸਾਂਝ ਵਰਗੇ ਐਡੇ ਐਡੇ ਤਕੜੇ ਕਲਾਕਾਰ ਕਿੰਨਾ ਮੋਟੀਵੇਟ ਕਰ ਰਿਹਾ ਹੁਣ ਕਈ ਮਾਂ ਤੁਹਾਡੀ ਸੋਚ ਵਧੀਆ ਲੱਗੀ ਮੈਨੂੰ ਕੋਈ ਤਾਂ ਮਾਂ ਬਾਪ ਮਾਂ ਬਾਪ ਮਾਂ ਬਾਪ ਕਹਿ ਦਿੰਦੇ ਆ ਬਈ ਬੱਚੇ ਨੂੰ ਮਿਊਜ਼ਕ ਨਹੀਂ ਸਿਖਾਉਣਾ ਬਈ ਇਹ ਸਟਡੀ ਵੱਲ ਉਹ ਕਰੇ ਜਾਂ ਉਹ ਕਰੇ ਤੁਹਾਡੀ ਸੋਚ ਵਧੀਆ ਲੱਗੀ ਤੁਸੀਂ ਮਿਊਜਿਕ ਵੱਲ ਦੇ ਰਹੇ ਹੋ ਕਿਉਂਕਿ ਮਿਊਜ਼ਿਕ ਸਰਸਵਤੀ ਮਾਤਾ ਨੇ ਗੁਣ ਹੀ ਦਿੱਤਾ ਸੀ ਸਭ ਦੇ ਅੰਦਰ ਵੀ ਕਈ ਇਸ ਨੂੰ ਪਹਿਚਾਣ ਲੈਂਦੇ ਆ ਕਈ ਨਹੀਂ ਪਛਾਣ ਪਾਉਂਦੇ ਤੁਸੀਂ ਪਹਿਚਾਨਿਆ ਵਧੀਆ ਸਾਡੇ ਕੋਲ ਲਾਇਆ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਧੰਨਵਾਦ